ਮੇਰਾ ਮਨਪਸੰਦ ਰਸਾਲਾ ਸ਼ਾਹਮੁਖੀ ਹੈ ਇਹ ਰਸਾਲਾ ਮੇਰਾ ਪਸੰ ਮਨਪਸੰਦ ਇਸ ਕਰਕੇ ਹੈ ਕਿਉਂਕਿ ਸ਼ਾਹਮੁਖੀ ਅਤੇ ਗੁਰਮੁਖੀ ਦੋਹਾਂ ਲਿੱਪੀਆਂ ਵਿੱਚ ਇੱਕੋ ਜਿਹਾ ਛਪਿਆ ਇਹ ਤਿਮਾਹੀ ਰਸਾਲਾ ਸਾਂਝ ਜਿਹੜਾ ਲਾਹੌਰ ਤੋਂ ਸ਼ਾਹਮੁਖੀ ਵਿੱਚ ਅਤੇ ਲੁਧਿਆਣਾ ਤੋਂ ਗੁਰਮੁਖੀ ਵਿੱਚ ਛਪ ਰਿਹਾ ਹੈ ਸਾਰੇ ਪੰਜਾਬੀਆਂ ਦੀ ਸਾਂਝ ਨੂੰ ਅੱਗੇ ਵਧਾਉਣ ਦਾ ਯਤਨ ਹੈ ਤਾਂ ਜੋ ਪੰਜਾਬੀਆਂ ਦੀਆਂ ਦੋ ਵੱਖ ਵੱਖ ਲਿੱਪੀਆਂ ਹੋਣ ਦੇ ਕਾਰਨ ਲਫ਼ਜਾਲੀ ਦੇ ਵੱਧ ਰਹੇ ਵਖਰੇਵੇਂ ਨੂੰ ਡਕ ਡੱਕਾ ਲੱਗੇ ਪੰਜਾਬੀ ਦੀਆਂ ਦੋਹਾਂ ਲਿੱਪੀਆਂ ਦੇ ਲਿਖਾਰੀਆਂ ਸੂਝਵਾਨਾਂ ਪੜ੍ਹਨਹਾਰਾਂ ਵਿੱਚ ਸੂਰਤ ਅਤੇ ਵਿਚਾਰਾਂ ਦੀ ਸਾਂਝ ਵਧੇ ਅਤੇ ਪੰਜਾਬੀ ਕਲਚਰ ਅਤੇ ਬੋਲੀ ਦੀ ਸਾਂਝ ਸੰਭਾਲ ਅਤੇ ਵਧਾ ਲਈ ਪੱਕੀ ਪੀੜ੍ਹੀ ਸਾਂਝ ਬਣੇ ਇਹ ਰਸਾਲਾ ਤਿੰਨਾਂ ਪੰਜਾਬਾਂ ਲਹਿੰਦੇ ਚੜ੍ਹਦੇ ਬਾਹਰਲੇ ਪੰਜਾਬ ਦੇ ਲਿਖਾਰੀਆਂ ਦੀ ਸੋਚ ਵਿਚਾਰ ਦਾ ਨੁਮਾਇਦਾ ਏ ਅਤੇ ਦੁਨੀਆਂ ਦੇ ਹਰ ਉਸ ਮੁਲਕ ਵਿੱਚ ਵੰਡਿਆ ਜਾਂਦਾ ਏ ਜਿੱਥੇ ਪੰਜਾਬੀ ਵੱਸਦੇ ਹਨ ਤਾਂ ਕਿ ਪੰਜਾਬੀ ਬੋਲੀ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕੀਤਾ ਜਾ ਸਕੇ ਕਿਉਂਕਿ ਵੱਧਦੇ ਵਿਸ਼ਵੀਕਰਨ ਦੇ ਕਾਰਨ ਲੋਕ ਪੰਜਾਬੀ ਬੋਲੀ ਨੂੰ ਭੁੱਲਦੇ ਜਾ ਰਹੇ ਹਨ ਬਹੁਤ ਹੀ ਅੰਤਰਰਾਸ਼ਟਰੀ ਭਾਸ਼ਾਵਾਂ ਜਿਵੇਂ ਕਿ ਫਰੈਂਚ ਫਰੈਂਚ ਕੋਰੀਅਨ ਲੈਂਗਵੇਜ਼ ਵੱਲ ਪ੍ਰਭਾਵਿਤ ਹੋ ਗਏ ਹਨ ਲੋਕ ਪੰਜਾਬੀ ਛੱਡ ਕੇ ਦੂਜੀਆਂ ਭਾਸ਼ਾਵਾ ਸਿੱਖਣ ਵਿੱਚ ਰੁਚੀ ਰੱਖਦੇ ਹਨ ਇਹ ਇਨ੍ਹਾਂ ਪ੍ਰਭਾਵਾਂ ਤੋਂ ਮੋੜ ਲਿਆਉਣ ਲਈ ਪੰਜਾਬ ਇਸ ਪੰਜਾਬੀ ਰ ਰਸਾਲੇ ਨੂੰ ਬਣਾਇਆ ਗਿਆ ਹੈ ਤਾਂ ਕਿ ਲੋਕ ਪੰਜਾਬੀਅਤ ਨੂੰ ਨਾ ਭੁੱਲਣ ਅਤੇ ਇਹ ਰਸਾਲਾ ਤਿੰਨੋਂ ਪੰਜਾਬਾਂ ਵਿੱਚ ਵਸਦੇ ਲੋਕਾਂ ਦੀ ਜਿਉਂਦੀ ਜਾਗਦੀ ਤਸਵੀਰ ਹੈ ਧੰਨਵਾਦ